ਨੀਤੀ ਏਜੰਟ ਸਾਡੀ ਖੇਤਰੀ ਭਾਸ਼ਾ ਵਿੱਚ ਸ਼ਰਤਾਂ ਦੀ ਵਿਆਖਿਆ ਨਹੀਂ ਕਰਦੇ ਹਨ ਉਹ ਸਾਨੂੰ ਕੋਈ ਵੀ ਗੱਲ ਸਾਫ ਸਾਫ ਨਹੀਂ ਦੱਸਦੇ ਹਨ ਕਿ ਹਾਂ ਖੁਦਾ ਨਾ ਖਾਸਤਾ ਕੱਲ੍ਹ ਨੂੰ ਇਹ ਕੁਛ ਵੀ ਹੋ ਜਾਂਦਾ ਹੈ ਤਾਂ ਤੁਹਾਨੂੰ ਇਹ ਇਹ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਪਰ ਜਦੋਂ ਉਹ ਫਾਰਮ ਭਰਾਉਂਦੇ ਹਨ ਜਾਂ ਕੋਈ ਵੀ ਏਜੰਟ ਜਦੋਂ ਕੋਈ ਪੋਲਿਸੀ ਕਰਦਾ ਹੈ ਤਾਂ ਸਾਨੂੰ ਉਹ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਹੈ ਕਿ ਕੱਲ੍ਹ ਨੂੰ ਕੁਝ ਵੀ ਹੋ ਜਾਵੇ ਤਾਂ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ ਪਰ ਜਦੋਂ ਕੋਈ ਹਾਦਸਾ ਜਾਂ ਕੁਝ ਵੀ ਅਣਹੋਣੀ ਹੋ ਜਾਂਦੀ ਹੈ ਤਾਂ ਉਹ ਸਾਨੂੰ ਕੁਛ ਵੀ ਇੰਨਾ ਵਧੀਆ ਰਿਸ ਜਵਾਬ ਨਹੀਂ ਦਿੰਦੇ ਹਨ ਉਹ ਇਹ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਪਹਿਲਾਂ ਇਹ ਦੱਸਿਆ ਸੀ ਜਾਂ ਉਹ ਕਿਹਾ ਸੀ ਪਰ ਉਹ ਇਹਨਾਂ ਬਾਰੇ ਕੁਝ ਵੀ ਨਹੀਂ ਦੱਸਦੇ ਹਨ ਜਦਕਿ ਫਾਰਮ ਤਾਂ ਸ਼ੁਰੂ ਸ਼ੁਰੂ ਵਿੱਚ ਤਾਂ ਭਾ ਖੇਤਰੀ ਭਾਸ਼ਾ ਵਿੱਚ ਦਿੱਤਾ ਹੁੰਦਾ ਹੈ ਜਿਹੜਾ ਕਿ ਅਸੀਂ ਆਸਾਨੀ ਦੇ ਨਾਲ ਭਰ ਸਕਦੇ ਹਾਂ ਪਰ ਜਦਕਿ ਜਿਹੜਾ ਬਾਕੀ ਦੀਆਂ ਉਹਨਾਂ ਦੀਆਂ ਵਿਚਲੀਆਂ ਸ਼ਰਤਾਂ ਹਨ ਉਹ ਸਾਰੀਆਂ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਵਿੱਚ ਹੁੰਦੀਆਂ ਹਨ ਜਿਹੜੀ ਕਿ ਆਮ ਬੰਦੇ ਦੀ ਸਮਝ ਤੋਂ ਬਾਹਰ ਹੁੰਦੀਆਂ ਹਨ ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬ ਰਾਜ ਨੂੰ ਚਾਹੀਦਾ ਹੈ ਕਿ ਇਹ ਸਾਰਾ ਫਾਰਮ ਅਤੇ ਜੋ ਵੀ ਨੀਤੀ ਏਜੰਟ ਕਰਨ ਵਾਲੇ ਹੁੰਦੇ ਹਨ ਆਮ ਭਾਸ਼ਾ ਵਿੱਚ ਲਿਖਣ ਤਾਂ ਜੋ ਆਮ ਜਨਤਾ ਨੂੰ ਇਸ ਵਾਪਸੀ ਇਸ ਹਾਦਸੇ ਦੇ ਬਾਰੇ ਕੁਛ ਵੀ ਕਿਹਾ ਜਾ ਸਕੇ ਜਿਹੜਾ ਕਿ ਕੋਈ ਵੀ ਹਾਦਸਾ ਹੋਵੇ ਉਹ ਆਪਣੀ ਆਪਣੀ ਮੁਸ਼ਕਲਾਂ ਨੂੰ ਹੱਲ ਕਰ ਸਕਣ ਤਾਂ ਜੋ ਕਿਸੇ ਏਜੰਟ ਦੇ ਜ਼ਿਆਦਾ ਤਰਲੇ ਮਿੰਨਤਾਂ ਨਾ ਕਰਨੇ ਪੈਣ ਕਿ ਉਹ ਉਹਨਾਂ ਨੇ ਇਸ ਫਾਰਮ ਨੂੰ ਭਰਾ ਕੇ ਕੋਈ ਨੁਕਸਾਨ ਤਾਂ ਨਹੀਂ ਕੀਤਾ ਕੋਈ ਆਪਣਾ ਨੁਕਸਾਨ

ਤਾਂ ਜੋ ਉਹਨਾਂ ਦੇ ਭਰੋਸੇ 'ਤੇ ਖਰੇ ਉੱਤਰ ਸਕਣ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਭਰੋਸਾ ਉਹ ਦਿੰਦੇ ਹਨ